ਸਾਰੇ ਹੀ ਪਿੰਡਾਂ ਦੇ ਲੋਕ ਆਪਣੇ ਬੱਚਿਆਂ ਨੂੰ ਪੋਲੀਓ ਦੇ ਟੀਕੇ ਲਗਵਾਉਂਦੇ ਹਨ ਹੋਸਪਿਟਲਾਂ 'ਚ ਹਰ ਸਾਲ 'ਚ ਦੋ ਵਾਰ ਸਰਕਾਰ ਵੱਲੋਂ ਮੁਹਿੰਮ ਚੱਲਦੀ ਹੈ ਛੋਟੇ ਬੱਚਿਆਂ ਨੂੰ ਪੋਲੀਓ ਦੇ ਡਰੋਪਸ ਪੋਲੀਓ ਦੇ ਟੀਕੇ ਲਗਾਏ ਜਾਂਦੇ ਹਨ ਜ਼ਿਆਦਾਤਰ ਹੀ ਹੋਸਪਿਟਲਾਂ 'ਚ ਛੋਟੇ ਛੋਟੇ ਬੱਚਿਆਂ ਨੂੰ ਟੀਕੇ ਲਗਾਏ ਜਾਂਦੇ ਹਨ ਉਹਨਾਂ ਦੇ ਕਾਰਡ ਵੀ ਬਣਾਏ ਜਾਂਦੇ ਹਨ ਉਹਦੇ ਮੁਤਾਬਕ ਉਹਨਾਂ ਨੂੰ ਪੰਜ ਸਾਲ ਸੱਤ ਸਾਲ ਦੀ ਉਮਰ ਤੱਕ ਟੀਕੇ ਲਗਾਏ ਜਾਂਦੇ ਹਨ ਪਿੰਡਾਂ ਦੇ ਵਿੱਚ ਵੀ ਸੈਂਟਰ ਲੱਗਦੇ ਹਨ ਹੈਲਥ ਸੈਂਟਰ ਲੱਗਦੇ ਹਨ ਕੈਂਪ ਲੱਗਦੇ ਹਨ ਸਾਰੇ ਬੱਚੇ ਉੱਥੋਂ ਮਾਂ ਪਿਓ ਦੀ ਮਰਜ਼ੀ ਦੇ ਨਾਲ ਟੀਕੇ ਲਗਵਾਉਂਦੇ ਹਨ ਬੜਾ ਸੋਹਣਾ ਉਪਰਾਲਾ ਹੈ ਪੋਲੀਓ ਖਤਮ ਹੋਣਾ ਚਾਹੀਦਾ ਹੈ ਸਰਕਾਰ ਬਹੁਤ ਸਾਲਾਂ ਤੋਂ ਕਰੋੜਾਂ ਅਰਬਾਂ ਰੁਪਈਏ ਲਗਾ ਕੇ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ ਸਾਨੂੰ ਸਾਰਿਆਂ ਨੂੰ ਹੀ ਪਿੰਡਾਂ ਵਾਲਿਆਂ ਨੂੰ ਸ਼ਹਿਰ ਵਾਲਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਹੋਸਪਿਟਲ 'ਚੋਂ ਟੀਕੇ ਲਗਵਾਉਣੇ ਚਾਹੀਦੇ ਹਨ ਔਰ ਕਾਰਡ ਬਣਾਉਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀ ਜਨਰੇਸ਼ਨ ਬੱਚੇ ਤੰਦਰੁਸਤ ਰਹਿਣ ਪੋਲਿਓ ਅਫੈਕਟਡ ਨਾ ਹੋਣ